ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੈਸ਼ਾਲੀ ਸ਼ਰਮਾ ਹੈ ਮੈਂ ਜ਼ਿਲ੍ਹਾ ਨਿਵਾਸੀ ਪਠਾਨਕੋਟ ਤੋਂ ਬੋਲ ਰਹੀ ਹਾਂ ਮੈਂ ਅੱਜ ਤੁਹਾਨੂੰ ਪੰਜਾਬ ਰਾਜ ਦੇ ਜ਼ਿਲ੍ਹੇ ਪਠਾਨਕੋਟ ਬਾਰੇ ਦੱਸਣ ਜਾ ਰਹੀ ਹਾਂ ਸਾਡੇ ਪਠਾਨਕੋਟ ਸ਼ਹਿਰ ਵਿੱਚ ਵੈਸੇ ਤਾਂ ਬਹੁਤ ਹੀ ਸਾਰੀਆਂ ਘੁੰਮਣ ਵਾਲੀਆਂ ਜਗ੍ਹਾ ਧਾਰਮਿਕ ਜਗ੍ਹਾ ਅਤੇ ਪੁਰਾਤਨ ਸਮੇਂ ਦੀਆਂ ਬਣੀਆਂ ਹੋਈਆਂ ਇਮਾਰਤਾਂ ਗੁਫਾਵਾਂ ਅਤੇ ਕਿਲ੍ਹੇ ਹਨ ਜਿਵੇਂ ਕਿ ਸਾਡੇ ਪਠਾਨਕੋਟ ਵਿੱਚ ਡਪਟਾਲ ਦੇ ਨੇੜੇ ਇੱਕ ਕਿਲ੍ਹਾ ਹੈ ਜੋ ਕਿ ਬਹੁਤ ਹੀ ਪੁਰਾਣਾ ਹੈ ਇੱਥੇ ਪੁਰਾਣੇ ਸਮੇਂ ਵਿੱਚ ਰਾਜੇ ਰਹਿੰਦੇ ਸੀ ਨਾਲ ਸਾਡੇ ਪਠਾਣਕੋਟ ਵਿੱਚ ਮੁਕੇਸ਼ਰ ਧਾਮ ਵਿੱਚ ਤਾਂ ਪਿੰਡ ਵਿੱਚ ਸ਼ਿਵਜੀ ਦੀ ਇੱਕ ਬਹੁਤ ਪੁਰਾਣੀ ਗੁਫਾ ਹੈ ਜਿੱਥੇ ਪਾਂਡਵਾਂ ਨੇ ਤਪੱਸਿਆ ਕੀਤੀ ਸੀ ਅੰਤ ਅਤੇ ਸਾਡੇ ਪਠਾਨਕੋਟ ਵਿੱਚ ਇੱਕ ਬਹੁਤ ਪੁਰਾਣਾ ਗੁਰਦੁਆਰਾ ਵੀ ਹੈ ਜੇ ਜੋ ਕਿ ਸ਼੍ਰੀ ਬਾਠ ਸਾਹਿਬ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਬੜਾ ਹੀ ਮਸ਼ਹੂਰ ਅਤੇ ਪੁਰਾਣਾ ਗੁਰਦੁਆਰਾ ਹੈ ਇੱਥੇ ਲੋਕ ਬੜੀ ਬੜੀ ਦੂਰ ਤੋਂ ਮੱਥਾ ਟੇਕਣ ਲਈ ਆਉਂਦੇ ਹਨ ਧੰਨਵਾਦ